ਇਤਿਹਾਸਕ ਸਥਾਨ ਵਿੱਚੋਂ ਛੋਟਾ ਘੱਲੂਘਾਰਾ ਸਾਹਿਬ ਗੁਰਦੁਆਰੇ ਦਾ ਇਤਿਹਾਸ ਹੈ ਘੱਲੂਘਾਰੇ ਦੀ ਦੀਵਾਨ ਲਖਪਤ ਰਾਏ ਅਤੇ ਸਿੰਘਾਂ ਵਿਚਕਾਰ ਦੋ ਜੇਠ ਅਠਾਰਾਂ ਸੌ ਤਿੰਨ ਨੂੰ ਕਾਹਨੂੰਵਾਨ ਦੇ ਛੰਬ ਨੇੜੇ ਵਾਪਰਿਆ ਇਸ ਦਾ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਲਖਪਤ ਰਾਏ ਦਾ ਭਰਾ ਜਸਪਤ ਰਾਏ ਈਮਾਨਾਬਾਦ ਦਾ ਸਰਕਾਰੀ ਅਹੁਦੇਦਾਰ ਦਾ ਸੀ ਜਿਸ ਪਾਸਪੁਰਲ ਜਿਸ ਪਾਸ ਮੁਗਲ ਹਕੂਮਤ ਵੱਲੋਂ ਦਿੱਤੀ ਹੋਈ ਕੁਝ ਫੌਜ ਵੀ ਸੀ ਇਮਾਨਾਬਾਦ ਕਸਬਾ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਅਤੇ ਉਹਨਾਂ ਦੇ ਮਿੱਤਰ ਭਾਈ ਲਾਲੋ ਜੀ ਦਾ ਸ਼ਹਿਰ ਸੀ ਇੱਥੇ ਸਿੱਖ ਹਰ ਸਾਲ ਗੁਰੂ ਨਾਨਕ ਦੇਵ ਜੀ ਦਾ ਜਨਮਦਿਨ ਬੜੀ ਧੂਮਧਾਮ ਨਾਲ ਮਨਾਉਂਦੇ ਸਨ ਜਦੋਂ ਇਹ ਪੂਰਬ ਚਲਾ ਗਿਆ ਤਾਂ ਮੁਗਲ ਹਕੂਮਤ ਦੇ ਇਸ ਪਾਲਤੂ ਨੇ ਸਿੱਖਾਂ ਉੱਪਰ ਹਮਲਾ ਕਰ ਦਿੱਤਾ ਜਿਸ ਵਿੱਚ ਇੱਕ ਹੰਕਾਰੀ ਮਾਰਿਆ ਗਿਆ ਜਦੋਂ ਆਪਣੇ ਭਰਾ ਦੇ ਮਾਰੇ ਜਾਣ ਦੀ ਖਬਰ ਲਾਹੌਰ ਦੇ ਸੂਬੇਦਾਰ ਦੇ ਦੀਵਾਨ ਲਖਪਤ ਰਾਏ ਨੂੰ ਲੱਗੀ ਤਾਂ ਉਹ ਗੁੱਸੇ ਵਿੱਚ ਪਾਗਲ ਹੋ ਗਿਆ ਉਸ ਨੇ ਲਾਹੌਰ ਦੇ ਸੂਬੇ ਦੇ ਸਾਹਮਣੇ ਪੇਸ਼ ਹੋ ਕੇ ਆਪਣੀ ਪੱਗ ਲਾਹ ਕੇ ਸੂਬੇ ਦੇ ਮੂਹਰੇ ਰੱਖਦੇ ਹੋਏ ਕਿਹਾ ਮੈਂ ਇਹ ਪੱਗ ਓਨੀ ਦੇਰ ਸਿਰ ਉੱਪਰ ਨਹੀਂ ਰੱਖਣੀ ਜਿੰਨੀ ਦੇਰ ਸਿੱਖਾਂ ਦਾ ਬੀਜ ਨਾਸ਼ ਨਹੀਂ ਕਰ ਦਿੰਦਾ ਉਸਨੇ ਬੜੇ ਹੰਕਾਰ ਨਾਲ ਕਿਹਾ ਕਿ ਸਿੱਖ ਧਰਮ ਸ਼ੁਰੂ ਵੀ ਇੱਕ ਖੱਤਰੀ ਨੇ ਕੀਤਾ ਸੀ ਅਤੇ ਹੁਣ ਇਸ ਨੂੰ ਖਤਮ ਵੀ ਇੱਕ ਖੱਤਰੀ ਹੀ ਕਰੇਗਾ ਇਹ ਕਹਿ ਕੇ ਉਸ ਨੇ ਇੱਕ ਬਹੁਤ ਵੱਡੀ ਮੁਗਲ ਫੌਜ ਲੈ ਕੇ ਸਿੱਖਾਂ ਉੱਪਰ ਹਮਲਾ ਕਰ ਦਿੱਤਾ ਜਿੱਥੇ ਦੋਹਾਂ ਧਿਰਾਂ ਦਾ ਬਹੁਤ ਵੱਡਾ ਜਾਨੀ ਨੁਕਸਾਨ ਹੋਇਆ ਮਗਰੋਂ ਇਹ ਇਹ ਪਾਪੀ ਮੁਗਲ ਸਰਕਾਰ ਨੂੰ ਆਪਣੀ ਜਗੀਰ ਦਾ ਟੈਕਸ ਨਾ ਉਤਾਰ ਸਕਿਆ ਅਤੇ ਇੱਕ ਸਿੱਖ ਨੇ ਇਸ ਦਾ ਟੈਕਸ ਹਾਰ ਕੇ ਇਸ ਨੂੰ ਖਰੀਦ ਲਿਆ ਇਸ ਦੀ ਮੌਤ ਵੀ ਸਿੱਖਾਂ ਹੱਥੋਂ ਚੰਦੂ ਬ੍ਰਾਹਮਣ ਵਾਂਗ ਬਹੁਤ ਭੈੜੇ ਤਰੀਕੇ ਨਾਲ ਹੋਈ ਉੱਨੀ ਸੌ ਸੰਤਾਲੀ ਤੋਂ ਮਗਰੋਂ ਪਾਕਿਸਤਾਨ ਦੇ ਕਿਸੇ ਸਿੱਖ ਵਿਰੋਧੀ ਮੁਸਲਮਾਨ ਅਧਿਕਾਰੀ ਨੇ ਇਸ ਦੇ ਨਾਂ 'ਤੇ ਲਾਹੋਰ ਵਿੱਚ ਇੱਕ ਜੇਲ੍ਹ ਦਾ ਨਾਂ ਕੋਟ ਲਖਪਤ ਰਾਏ ਰੱਖ ਦਿੱਤਾ ਹੈ